ਹੈਲੋ ਪ੍ਰਕਾਸ਼ ਸਿੰਘ ਜੀ ਅਸੀਂ ਇੱਥੋਂ ਹਰਿਆਣੇ ਦੇ ਰਹਿੰਦੇ ਸੀਗੇ ਪਹਿਲਾਂ ਹੁਣ ਇੱਥੇ ਪੰਜਾਬ ਦੇ ਵਿੱਚ ਆਏ ਹਾਂ ਅਤੇ ਸਾਨੂੰ ਮਤਲਬ ਕਿ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਦਿਉਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਨੂੰ ਦੱਸੋ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ